ਮੇਰੇ ਤੋਂ ਕੰਮ 'ਤੇ ਗਲਤੀ ਹੋਈ ਕਿ ਮੇਰੇ ਕੋਲ ਟਰੇਅ ਸੀਗੀ ਅਤੇ ਉਹ ਅਚਾਨਕ ਛੁੱਟ ਗਈ ਨੀਚੇ ਡਿੱਗੀ ਅਤੇ ਉਹਦੇ ਦੋ ਟੁਕੜੇ ਹੋ ਗਏ ਅਤੇ ਮੈਂ ਇੱਧਰ ਉੱਧਰ ਦੇਖਿਆ ਮੈਨੂੰ ਕਿਸੇ ਨੇ ਦੇਖਿਆ ਨਹੀਂ ਮੈਂ ਫਟਾਫਟ ਉਹ ਟਰੇਅ ਜਿਹੜੀ ਸੀਗੀ ਲੁਕੋ ਕੇ ਰੱਖਤੀ ਐਜ਼ ਆ ਟੈਂਪਰਰੀ ਅਤੇ ਫਟਾਫਟ ਦਫ਼ਤਰ 'ਚ ਦੇਖ ਗਈ ਉੱਥੇ ਫੈਵੀਕਵਿੱਕ ਪਿਆ ਸੀ ਫੈਵੀਕਵਿੱਕ ਲਿਆ ਕੇ ਮੈਂ ਉਹ ਟਰੇਅ ਜੋੜ ਕੇ ਉੱਥੇ ਸਾਫ਼ ਸੁਥਰੀ ਕਰ ਕੇ ਰੱਖਤੀ ਅਤੇ ਆਪ ਦੂਜੇ ਕੰਮ 'ਚ ਲੱਗ ਗਈ ਫਿਰ ਸਾਨੂੰ ਪੰਦਰਾਂ ਕੁ ਦਿਨ ਦੀਆਂ ਛੁੱਟੀਆਂ ਹੋ ਗਈਆਂ ਥੋੜ੍ਹੇ ਟਾਈਮ ਬਾਅਦ ਮੈਂ ਦੇਖਿਆ ਵੀ ਉਹ ਟਰੇਅ ਕਿਸੇ ਹੋਰ ਨੇ ਚੱਕੀ ਉਹਦੇ 'ਚ ਥੋੜ੍ਹਾ ਸਮਾਨ ਹੀ ਰੱਖਣ ਲੱਗੇ ਸੀ ਕਿ ਉਹ ਫੈਵੀਕਵਿੱਕ ਦਾ ਜਿਹੜਾ ਜੋੜ ਸੀਗਾ ਉਹ ਖੁੱਲ੍ਹ ਗਿਆ ਉਹ ਟੁੱਟ ਗਈ ਅਤੇ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਸਮਾਨ ਦੇ ਭਾਰ ਨਾਲ਼ ਟੁੱਟ ਗਈ ਇਸ ਤਰੀਕੇ ਨਾਲ਼ ਮੇਰਾ ਕੰਮ ਸਰ ਗਿਆ ਅਤੇ ਮੇਰੇ 'ਤੇ ਕੋਈ ਇਲਜ਼ਾਮ ਵੀ ਨਹੀਂ ਆਇਆ ਅਤੇ ਮੇਰਾ ਗਲਤੀ 'ਤੇ ਮੇਰੀ 'ਤੇ ਪਰਦਾ ਪੈ ਗਿਆ